ਸਰ ਮੈਂ ਗੁਰਲਾਲ ਬੋਲਦਾ ਹਾਂ ਮੈਂ ਮਾਨਾ ਵਾਲੇ ਤੋਂ ਹਾਂ ਮੈਂ ਕੁਝ ਦਿਨ ਪਹਿਲੇ ਤੁਹਾਡੀ ਟਰਾਂਸਪੋਰਟ ਏਜੰਸੀ ਤੋਂ ਕੈਬ ਬੁੱਕ ਕੀਤੀ ਸੀ ਅਸੀਂ ਅੱਜ ਏਅਰਪੋਰਟ ਦੇ ਜਾਣ ਜਾਣਾ ਸੀ ਅਸੀਂ ਏਅਰਪੋਰਟ ਜਾਣਾ ਸੀ ਸਾਡੀ ਫਲਾਈਟ ਸੀ ਅੱਜ ਦੀ ਅਸੀਂ ਮੁੰਬਈ ਜਾਣਾ ਸੀ ਤੁਸੀਂ ਸਾਡੀ ਫਲਾਈਟ ਮਿਸ ਕਰਵਾ ਦਿੱਤੀ ਹੈ ਮੈਂ ਬਹੁਤ ਨੁਕਸਾਨ ਮੇਰਾ ਬਹੁਤ ਨੁਕਸਾਨ ਹੋਇਆ ਹੈ ਤੁਹਾਡਾ ਕੈਬ ਵਾਲਾ ਟਾਈਮ 'ਤੇ ਸਾਡੇ ਕੋਲ ਨਹੀਂ ਪਹੁੰਚਿਆ ਜੇ ਤੁਸੀਂ ਨਹੀਂ ਟਾਈਮ ਨਾਲ ਕੈਬ ਭੇਜਣੀ ਸੀ ਤਾਂ ਪਹਿਲਾਂ ਹੀ ਦੱਸ ਦਿੰਦੇ ਅਸੀਂ ਕਿਸੇ ਹੋਰ ਨਾਲ ਗੱਲ ਕਰ ਲੈਂਦੇ ਤੁਹਾਡੀ ਸਰਵਿਸ ਬਹੁਤ ਮਾੜੀ ਹੈ ਮੇਰੇ ਬੁਕਿੰਗ ਦੇ ਸਾਰੇ ਪੈਸੇ ਵਾਪਸ ਚਾਹੀਦੇ ਹਨ ਮੈਨੂੰ ਦੱਸੋ ਮੈਂ ਕਿਸ ਦਿਨ ਪੈਸੇ ਲੈਣ ਆਵਾਂ